ਹੈਲੋ ਗੁਡ ਮੋਰਨਿੰਗ ਮੈਮ ਮੈਮ ਐਕਚੁਲੀ ਨਾ ਬੜੀ ਪ੍ਰੋਬਲਮ ਚੱਲਦੀ ਪਈ ਆ ਬੱਚਿਆਂ ਦੀ ਬੱਚੇ ਅੱਜ ਕੱਲ੍ਹ ਨਾ ਅ ਮਤਲਬ ਅਸੀਂ ਉਹਨਾਂ ਨੂੰ ਮਾਰ ਵੀ ਨਹੀਂ ਸਕਦੇ ਸਲੈਪ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਟੱਚ ਤੱਕ ਨਹੀਂ ਕਰ ਸਕਦੇ ਅਤੇ ਹੁਣ ਪ੍ਰੋਬਲਮ ਇਹ ਆ ਕਿ ਫਿਰ ਅਸੀਂ ਉਹਨਾਂ ਨੂੰ ਕਿਵੇਂ ਮਤਲਬ ਕਲਾਸ ਦੇ ਵਿੱਚ ਡਿਸਿਪਲਿਨ ਦੇ ਵਿੱਚ ਰੱਖੀਏ ਇੱਕ ਅੱਧਾ ਬੱਚਾ ਇਸ ਤਰ੍ਹਾਂ ਦਾ ਹਰ ਕਲਾਸ ਦੇ ਵਿੱਚ ਹੈਗਾ ਹੀ ਆ ਅਤੇ ਜਿਹੜਾ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਉਹਦੇ ਲਈ ਫਿਰ ਕੁਛ ਨਾ ਕੁਛ ਤਾਂ ਸਾਨੂੰ ਅਜਿਹਾ ਮਤਲਬ ਕੁਛ ਸਲਿਊਸ਼ਨ ਮਿਲਣਾ ਚਾਹੀਦਾ ਕਿ ਜਿਹਦੇ ਨਾਲ ਉਹਨਾਂ ਬੱਚਿਆਂ ਨੂੰ ਚੁੱਪ ਕਰਕੇ ਬਿਠਾਇਆ ਜਾ ਸਕੇ ਅਦਰਵਾਈਜ਼ ਉਹ ਸਾਰਿਆਂ ਨੂੰ ਫਿਰ ਪ੍ਰੋਬਲਮ ਕ੍ਰੀਏਟ ਕਰਵਾ ਦਿੰਦੇ ਆ ਸਾਨੂੰ ਮਤਲਬ ਕੋਈ ਨਾ ਕੋਈ ਇਹੋ ਜਿਹਾ ਸਲਿਊਸ਼ਨ ਮਿਲੇ ਤਾਂ ਕਿ ਸਾਡੀ ਵੀ ਸੈਲਫ ਰਿਸਪੈਕਟ ਬਣੀ ਰਹੇ ਹਾਂਜੀ ਹਾਂਜੀ ਉਹ ਤਾਂ ਮੈਮ ਉਹ ਤਾਂ ਮੈਮ ਮੈਂ ਸਮਝਦਾ ਹਾਂ ਕਿ ਮਤਲਬ ਸਾਡੀ ਹੀ ਜਿੰਮੇਵਾਰੀ ਆ ਸਕੂਲ ਦੇ ਵਿੱਚ ਅਸੀਂ ਉਹਨਾਂ ਨੂੰ ਡਿਸਿਪਲਨ ਦੇ ਵਿੱਚ ਰੱਖਣਾ ਪਰ ਫਿਰ ਵੀ ਮੈਂ ਚਾਹੁੰਦਾ ਕੁਛ ਨਾ ਕੁਛ ਤਾਂ ਅਜਿਹਾ ਕੋਈ ਸਟੈੱਪ ਹੋਣਾ ਚਾਹੀਦਾ ਕਿ ਮਤਲਬ ਹੁਣ ਜੇਕਰ ਬੱਚਾ ਬਹੁਤ ਤੰਗ ਕਰਦਾ ਪਿਆ ਉਹਨੂੰ ਰੈਸਟੀਗੇਟ ਕਰ ਦਿੱਤਾ ਜਾਵੇ ਜਾਂ ਸਸਪੈਂਡ ਕਰ ਦਿੱਤਾ ਜਾਵੇ ਤਾਂ ਕਿ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਠੀਕ ਹੈ ਠੀਕ ਹੈ ਮੈਮ ਠੀਕ ਹੈ ਠੀਕ ਹੈ ਮੈਮ ਠੀਕ ਹੈ ਓਕੇ ਮੈਮ ਥੈਂਕ ਯੂ ਥੈਂਕ ਯੂ ਧੰਨਵਾਦ ਮੈਮ